ਸਾਡੀ ਜ਼ਿੰਦਗੀ ਵਿੱਚ ਪੜ੍ਹਾਈ ਬਹੁਤ ਜ਼ਰੂਰੀ ਹੈ ਜੇ ਉਹ ਬੰਦਾ ਪੜ੍ਹ ਲਿਖ ਜਾਂਦਾ ਹੈ ਉਹ ਵਧੀਆ ਕੰਮ 'ਤੇ ਕਿਤੇ ਵਧੀਆ ਨੌਕਰੀ 'ਤੇ ਲੱਗ ਜਾਂਦਾ ਹੈ ਜਦੋਂ ਅਸੀਂ ਪੜ੍ਹਦੇ ਸੀ ਅਤੇ ਅਸੀਂ ਘੱਟ ਪੜ੍ਹਾਈ ਕੀਤੀ ਹੈ ਪਰ ਸਾਨੂੰ ਇਸ ਵਜ੍ਹਾ ਨਾਲ ਵਧੀਆ ਨੌਕਰੀ ਨਹੀਂ ਮਿਲੀ ਅਤੇ ਅਸੀਂ ਆਪਣੇ ਹੱਥੀਂ ਕੰਮ ਕੀਤਾ ਹੈ ਆਪਣੀ ਕੰਮ ਸਿੱਖਿਆ ਅਤੇ ਉਸਦੇ ਦੁੱਬਕੇ ਅਸੀਂ ਕੰਮ ਕਰ ਰਹੇ ਹਾਂ ਅੱਜ ਕੱਲ੍ਹ ਇਹ ਹੈ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਕੰਪਿਊਟਰ ਦਾ ਜ਼ਮਾਨਾ ਹੈ ਜੋ ਵੀ ਬੰਦਾ ਪੜ੍ਹ ਲਿਖ ਜਾਂਦਾ ਹੈ ਉਹ ਵਧੀਆ ਨੌਕਰੀ ਕੋਈ ਵਧੀਆ ਆਸਾਮ 'ਤੇ ਲੱਗ ਜਾਂਦਾ ਹੈ ਅਤੇ ਨਹੀਂ ਤਾਂ ਦਿਹਾ ਦਿਨ ਵਿੱਚ ਧੱਕੇ ਹੀ ਖਾਣੇ ਪੈਂਦੇ ਹਨ ਅਸੀਂ ਡਰਾਇਵਰੀ ਕੀਤੀ ਹੈ ਡਰਾਈਵਰੀ ਸਿੱਖੀ ਹੈ ਪਰ ਇਹਦੇ ਵਿੱਚ ਵੀ ਇੰਨਾਂ ਰਿਸਕ ਹੈ ਇੰਨਾਂ ਜ਼ਿਆਦਾ ਜੋਖਿਮ ਹੈ ਦਿਨ ਰਾਤ ਜਾਗ ਕੇ ਹੀ ਕੱਟਣਾ ਪੈਂਦਾ ਹੈ ਅਤੇ ਜੇਕਰ ਪੜ੍ਹਾਈ ਕੀਤੀ ਹੁੰਦੀ ਅਤੇ ਔਫਿਸ ਵਿੱਚ ਕਿਤੇ ਦਫ਼ਤਰ ਵਿੱਚ ਬੈਠੇ ਹੁੰਦੇ ਦਫ਼ਤਰ ਵਿੱਚ ਬੈਠੇ ਅੱਠ ਘੰਟੇ ਡਿਊਟੀ ਕਰਦਾ ਬੰਦਾ ਸਾਫ਼ ਸੁਥਰਾ ਕੰਮ ਕਰਦਾ ਹੈ ਅਤੇ ਵਧੀਆ ਪੈਸੇ ਕਮਾਉਂਦਾ ਹੈ ਅਤੇ ਉਹਨੂੰ ਕੋਈ ਦਿੱਕਤ ਨਹੀਂ ਹੁੰਦੀ ਅਤੇ ਵਧੀਆ ਜ਼ਿੰਦਗੀ ਦਾ ਗੁਜ਼ਾਰਾ ਚੱਲਦਾ ਹੈ ਉਹਦਾ